ਪੰਜਾਬ ਪੰਜਾਬ ਵਿੱਚ ਰਾਜ ਸਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਦੀ ਹੈ ਅਤੇ ਕਿਵੇਂ ਹੱਲ ਕਰਨੀ ਹੈ ਸਰਕਾਰ ਜਿਹੜੀ ਹ ਬਹੁਤ ਜਿਆਦਾ ਆਪਣਾ ਕੰਮ ਕਰ ਰਹੀ ਹੈ ਇਹ ਭਾਈਚਾਰਾ ਲਿਆ ਰਹੀ ਇਹ ਜਿਹੜਾ ਸੀ ਕੀ ਜਿਹੜਾ ਭਾਈਚਾਰਾ ਲਿਆ ਰਹੀ ਹ ਜਿਹੜਾ ਕਿ ਜਿਹੜੇ ਕਿਸੇ ਦੇ ਇਸ ਪੈਸ਼ਨਾਂ ਜਿਨਾਂ ਵੀ ਲੋਕਾਂ ਦੀ ਵਧਾ ਰਹੀ ਹ ਬੜਾਪੇ ਚ ਵੀ ਕਰ ਰਹੀ ਹ ਸਿਹਤ ਵੀ ਕਰ ਰਹੀ ਹ ਬੜੇ ਡਿਸਪੈਂਸਰੀਆਂ ਖੋਲ ਰਹੀ ਹ ਤੇ ਇਹ ਜਿਹੜੀ ਉਗਰਵਾਦ ਨੂੰ ਵੀ ਖਤਮ ਕਰ ਰਹੀ ਹ ਤੇ ਨਸ਼ੇ ਪਤੇ ਨੂੰ ਇਹ ਖਤਮ ਕਰ ਰਹੀ ਹ ਸਰਕਾਰ ਕੇ ਸਰਕਾਰ ਜਿਹੜੀ ਹ ਸਰਕਾਰ ਬਹੁਤ ਕੰਮ ਕਰ ਰਹੀ ਹ ਜਿਹੜੀ ਕਿ ਬੁੜਾਪੇ ਦੀ ਸਿਹਤ ਦਾ ਵੀ ਖਿਆਲ ਰੱਖ ਰਹੀ ਹੈ ਉਹਨਾਂ ਦੇ ਕਾਰਡ ਬਣਾ ਰਹੇ ਉਹਨਾਂ ਨੂੰ ਸਭ ਕੁਛ ਸੋ ਉਹਨਾਂ ਦੀ ਦਵਾਈਆਂ ਵਗੈਰਾ ਵੀ ਦੇ ਰਹੇ ਨੇ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਦਵਾਈਆਂ ਲੋ ਆਪਣੇ ਫਰੀ ਵਿੱਚ ਸਭ ਕੁਝ ਕਰ ਰਹੇ ਤੇ ਉਹਨਾਂ ਨੂੰ ਪੈਨਸ਼ਨਾਂ ਵੀ ਦੇ ਰਹੀ ਹ ਤੇ ਉਹ ਜਿਹੜੇ ਬਹੁਤ ਬਹੁਤ ਮਸਲੇ ਹੱਲ ਕਰ ਰਹੇ ਸਕੂਲਾਂ ਦੇ ਮਸਲੇ ਹੱਲ ਕਰ ਰਹੀ ਹ ਗੱਡੀਆਂ ਗੱਡੀਆਂ ਉਹਨਾਂ ਨੇ ਰੱਖੀਆ ਉਹਨਾਂ ਦੇ ਵਾਸਤੇ ਜੇ ਕੋਈ ਬਿਮਾਰ ਹੋਜੇ ਜੇ ਕੋਈ ਕਿਸੇ ਦੀ ਕਿਸੇ ਦਾ ਐਕਸੀਡੈਂਟ ਹੋ ਜੇ ਕੁਛ ਹੋ ਜੇ ਸਭ ਕੁਝ ਇਹ ਕਰ ਰਹੀ ਹ ਸਰਕਾਰ ਜਿਹੜੀ ਹ ਬਹੁਤ ਜਿਆਦਾ ਇਸ ਵੇਲੇ ਸਾਨੂੰ ਇਦਾ ਬੜਾ ਵੀ ਸਹਾਰਾ ਹੈ ਸਰਕਾਰ ਦਾ ਇਹ ਸਰਕਾਰ ਜਿਹੜੀ ਹ ਬਹੁਤ ਕਾਮਯਾਬ ਹੈ ਤੇ ਪੰਜਾਬ ਦੇ ਸਾਰੇ ਟੈਰੀਜ਼ਮ ਨੂੰ ਵੀ ਖਤਮ ਕਰ ਰਹੀ ਹੈ ਸਭ ਨਸ਼ੇ ਪੱਤੇ ਸਭ ਤੇ ਖਤਮ ਕਰ ਰਹੀ ਤੇ ਉਸਕਾ ਜਿਹੜੀ ਐ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰਿਆਂ ਲਈ ਤੇ ਇਹ ਸਰਕਾਰ ਦਾ ਬੜਾ ਬੜਾ ਬੜਾ ਬੜਾ ਸ਼ੁਕਰੀਆ ਵਾ ਧੰਨਵਾਦ ਐ ਧੰਨਵਾਦ ਐ ਧੰਨਵਾਦ ਐ ਧੰਨਵਾਦ ਐ ਧੰਨਵਾਦ